ਵੈਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਰਕਾਰੀ ਐਪ ਨੇ ਜੋ ਮੈਂ ਯੂਸ ਕਰਦਾ ਹਾਂ ਉਹਨਾਂ ਵਿੱਚੋਂ ਇੱਕ ਆਈ ਆਰ ਸੀ ਟੀ ਸੀ ਐਪ ਹੈ ਜਿਹਦੇ ਵਿੱਚ ਮੈਂ ਆਪਣੀ ਟਰੇਨ ਦੀ ਟਿਕਟ ਬੁੱਕ ਕਰ ਸਕਦਾ ਹਾਂ ਮੈਂ ਮੈਨੂੰ ਘੁੰਮਣ ਦਾ ਕਾਫੀ ਸ਼ੌਂਕ ਹੈ ਇਸ ਕਰਕੇ ਮੈਂ ਹਰ ਮਹੀਨੇ ਲਗਭਗ ਆਪਣੇ ਟਰੇਨ ਦੀ ਟਿਕਟ ਬੁੱਕ ਕਰਕੇ ਉ ਉਸਦੇ ਰਾਹੀਂ ਅਤੇ ਘੁੰਮਣ ਲਈ ਨਿਕਲ ਜਾਂਦਾ ਹਾਂ ਉਸ ਐਪ ਵਿੱਚ ਮੈਂ ਟਿਕਟ ਬੁੱਕ ਕਰਨ ਦੇ ਨਾਲ ਨਾਲ ਆਪਣੀ ਟਿਕਟ ਕੈਂਸਲ ਕਰਕੇ ਆਪਣਾ ਰਿਫੰਡ ਪ੍ਰਾਪਤ ਕਰ ਸਕਦਾ ਹਾਂ ਅਤੇ ਆਪਣਾ ਭੋਜਨ ਵੀ ਆਪਣੀ ਟਰੇਨ ਦੇ ਵਿੱਚ ਮੰਗਾ ਸਕਦਾ ਹਾਂ ਇਸ ਤੋਂ ਇਲਾਵਾ ਮੈਂ ਇੱਕ ਡੀਜ਼ੀ ਲੌਕਰ ਨਾਮ ਦੀ ਐਪ ਵੀ ਬਹੁਤ ਯੂਸ ਕਰਦਾ ਹਾਂ ਕਿਉਂਕਿ ਮੈਨੂੰ ਆਪਣੇ ਡੌਕੂਮੈਂਟਸ ਨਾਲ ਕੈਰੀ ਕਰਨ ਦੀ ਲੋੜ ਨਹੀਂ ਪੈਂਦੀ ਉਸ ਵਿੱਚ ਮੈਂ ਆਪਣੇ ਡੌਕੂਮੈਂਟਸ ਡਿਜੀਟਲ ਹੀ ਮੈਂ ਆਪਣੇ ਅਪਲੋਡ ਕਰ ਸਕਦਾ ਹਾਂ ਮੇਰਾ ਆਧਾਰ ਕਾਰਡ ਮੇਰਾ ਜਨਮ ਜਨਮ ਸਰਟੀਫਿਕੇਟ ਮੇਰਾ ਆਏ ਸਰਟੀਫਿਕੇਟ ਅਤੇ ਮੇਰੇ ਬਹੁਤ ਸਾਰੇ ਸਰਟੀਫਿਕੇਟ ਐਵੇਂ ਦੇ ਦਸਵੀਂ ਬਾਰ੍ਹਵੀਂ ਦੇ ਜੋ ਮੈਂ ਨਾਲ ਲੈ ਕੇ ਘੁੰਮਣ ਦੀ ਬਜਾਏ ਆਪਣੇ ਡੀਜੀ ਲੌਕਰ ਐਪ ਵਿੱਚ ਰੱਖ ਕੇ ਜਿੱਥੇ ਵੀ ਮੈਨੂੰ ਲੋੜ ਪਵੇ ਮੈਂ ਉੱਥੇ ਦਿਖਾ ਸਕਦਾ ਹਾਂ ਇਸ ਤੋਂ ਇਲਾਵਾ ਇੱਕ ਐੱਮ ਆਧਾਰ ਨਾਮ ਦੀ ਐਪ ਹੈ ਜੋ ਮੈਂ ਯੂਸ ਕਰਦਾ ਹਾਂ ਕਿਉਂਕਿ ਮੈਨੂੰ ਆਧਾਰ ਦੀਆਂ ਸੇਵਾਵਾਂ ਲੈਣ ਦੀ ਜਦੋਂ ਲੋੜ ਪੈਂਦੀ ਹੈ ਕਿਉਂਕਿ ਮੈਂ ਪੀ ਬਾਈ ਪੀ ਵੀ ਸੀ ਕਾਰਡ ਇੱਕ ਆਧਾਰ ਦਾ ਮੰਗਵਾਇਆ ਸੀ ਜੋ ਮੈਂ ਐੱਮ ਆਧਾਰ ਐਪ ਤੋਂ ਔਡਰ ਕੀਤਾ ਸੀਗਾ ਇਸ ਕਰਕੇ ਮੈਂ ਉਸਦੀ ਐਪ ਦੀ ਵਰਤੋਂ ਕੀਤੀ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਐਪਸ ਨੇ ਪਰ ਇਹ ਐਪ ਦੀ ਯੂਜ ਮੈਂ ਵਰਤੋਂ ਬਹੁਤ ਜ਼ਿਆਦਾ ਕਰਦਾ ਹਾਂ